ਭੰਗੜਾ ਐਰੋਬਿਕਸ ਨੇ ਮੇਰੇ ਜੀਵਨ ਵਿੱਚ ਇੱਕ ਅਹਿਮ ਤਬਦੀਲੀ ਲਿਆਈ ਹੈ ਜਿਸ ਦਾ ਅਨੁਭਵ ਮੈਂ ਬਹੁਤ ਖੁਸ਼ੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਪਹਿਲਾਂ ਜਦੋਂ ਮੇਰੇ ਜੀਵਨ ਵਿੱਚ ਸਰੀਰਕ ਕਸਰਤ ਦੇ ਅਹਿਸਾਸ ਦੀ ਗੱਲ ਆਈ ਮੈਂ ਖੁਦ ਨੂੰ ਬਹੁਤ ਬੈਚੈਨ ਮਹਿਸੂਸ ਕਰਦਾ ਸੀ ਅਤੇ ਵੇਆਹ ਵੇਆਹਜਾਮ ਕਰਨ ਵਿੱਚ ਮਨੋਬਲ ਦੀ ਘਾਟ ਸੀ ਫਿਰ ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਭੰਗੜਾ ਐਰੋਬਿਕਸ ਦੀ ਕਲਾਸ ਦੀ ਸਿਫਾਰਿਸ਼ ਕੀਤੀ ਜੋ ਉਸ ਦੇ ਮੁਤਾਬਿਕ ਨਾ ਸਿਰਫ ਮਜੇਦਾਰ ਸੀ ਸਗੋਂ ਸਿਹਤ ਦੇ ਲਈ ਵੀ ਬਹੁਤ ਲਾਭਦਾਇਕ ਸੀ ਸ਼ੁਰੂ ਵਿੱਚ ਮੈਂ ਥੋੜਾ ਹੌਸਲਾ ਹਾਰਿਆ ਪਰ ਜਿਵੇਂ ਹੀ ਮੈਂ ਕਲਾਸ ਵਿੱਚ ਪੈਦਾ ਹੋਈਆਂ ਮੈਂ ਤੁਰੰਤ ਰਿਥਮ ਅਤੇ ਊਰਜਾ ਦੇ ਸਦਭਾਵਨ ਦੀ ਮਹਿਸੂਸ ਕੀਤੀ ਭੰਗੜੇ ਦੇ ਤੇਜ਼ ਤੇਜ਼ ਤਾਲ ਅਤੇ ਜ਼ਿੰਦਗੀ ਦਾ ਭਰਪੂਰ ਗਤੀਵਿਧੀਆਂ ਨੇ ਮੇਰੇ ਮਨੋਵਲ ਨੂੰ ਤਾਜ਼ਾ ਕੀਤਾ ਅਤੇ ਮੇਰੀ ਦਿਨਚਰਿਆ ਵਿੱਚ ਨਵਾਂ ਉਤਸਾਹ ਭਰ ਦਿੱਤਾ ਸਫਲਤਾ ਦੀ ਮਹਿਸੂਸ ਨੇ ਮੈਨੂੰ ਪੂਰੇ ਦਿਨ ਸ਼ਕਤੀਸ਼ਾਲੀ ਅਤੇ ਊਰਜਾਬਾਣ ਮਹਿਸੂਸ ਕਰਨ ਵਿੱਚ ਬਹੁਤ ਹੀ ਜਿਆਦਾ ਮਦਦ ਕੀਤੀ ਮੇਰੀ ਸਿਹਤ ਵਿੱਚ ਵੀ ਗਹਿਰਾ ਸੁਧਾਰ ਆਉਣ ਲੱਗਾ ਮੇਰੇ ਦਿਲ ਦੀ ਸਿਹਤ ਬਹੁਤ ਵਧੀਆ ਹੋਣ ਲੱਗੀ ਮੇਰੇ ਸਰੀਰ ਦੀ ਜੋ ਚਰਬੀ ਸੀ ਉਹ ਵੀ ਹੌਲੀ ਹੌਲੀ ਘਟਣ ਲੱਗੀ ਮੇਰਾ ਪੇਟ ਵੀ ਘਟਣ ਲੱਗ ਗਿਆ ਮੇਰਾ ਸਰੀਰ ਫਿਟ ਰਹਿਣ ਲੱਗਿਆ ਇਸ ਤੋਂ ਇਲਾਵਾ ਭੰਗੜਾ ਐਰੋਬਿਕਸ ਨੇ ਮੈਨੂੰ ਇੱਕ ਨਵੀਂ ਸਾਂਝੀ ਦੁਨੀਆਂ ਦਿੱਤੀ ਜਿੱਥੇ ਮੈਂ ਰੋਜ਼ਾਨਾ ਕਲਾਸਾਂ ਲਾਉਂਦਾ ਸੀ ਤਾਂ ਮੇਰੇ ਨਵੇਂ ਨਵੇਂ ਫ੍ਰੈਂਡ ਮਿਲਦੇ ਮੈਨੂੰ ਨਵੇਂ ਯਾਰ ਦੋਸਤ ਮਿਲਦੇ ਅਸੀਂ ਇਕੱਠੇ ਹੁੰਦੇ ਉਸਨੇ ਵੀ ਮੇਰੇ ਦੁਨੀਆ ਸਾਂਝੀ ਕਰੀ ਜਿੱਥੇ ਮੈਂ ਸੰਗੀਤ ਦੇ ਰਿਸਮ ਵਿੱਚ ਡੁਬਕੀ ਲਗਾ ਸਕਦਾ ਹਾਂ ਨਵੇਂ ਦੋਸਤ ਬਣਾ ਸਕਦਾ ਕਲਾਸਾਂ ਵਿੱਚ ਸ਼ਾਮਿਲ ਹੋਣਾ ਮੇਰੇ ਦੋਸਤਾਂ ਦਾ ਪਰਿਵਾਰ ਨਾਲ ਵੀ ਮੇਰੇ ਰਿਸ਼ਤੇ ਮਜਬੂਤ ਹੋਏ ਹਨ ਕਿਉਂਕਿ ਅਸੀਂ ਇਸ ਤਜਰਬੇ ਨੂੰ ਮਿਲ ਕੇ ਸਾਂਝਾ ਕਰਦੇ ਹਾਂ ਇਸ ਤਰ੍ਹਾਂ ਭੰਗੜਾ ਐਰੋਬਿਕਸ ਨੇ ਨਾ ਸਿਰਫ ਮੇਰੀ ਸਿਹਤ ਨੂੰ ਸੁਧਾਰਿਆ ਸਗੋਂ ਮੇਰੀ ਜਿੰਦਗੀ ਵਿੱਚ ਵੀ ਖੁਸ਼ੀ ਅਤੇ ਪ੍ਰਫੁੱਲਤਾ ਵੀ ਭਰੀ ਹੈ